ਸਭ ਤੋਂ ਚੁਣੌਤੀਪੂਰਨ ਵਿਅੰਜਨ ਮੇਰੇ ਲਈ ਮੂੰਗੀ ਦਾਲ ਦਾ ਹਲਵਾ ਸੀ ਜਦੋਂ ਮੈਂ ਉਸਨੂੰ ਬਣਾਉਂਦਾ ਸੀ ਕਈ ਵਾਰ ਦਾਲ ਕੱਚੀ ਰਹਿ ਜਾਂਦੀ ਸੀ ਅਤੇ ਉਹਨੂੰ ਪੀਸਣ ਟਾਈਮ ਜਦੋਂ ਬਣਾਉਣਾ ਅਤੇ ਕੜਾਹੀ ਵਿੱਚ ਪਾ ਕੇ ਜਦੋਂ ਪਕਾਉਂਦਾ ਸੀ ਕਦੇ ਕਦੇ ਚਿਪਕਦਾ ਰਹਿ ਜਾਂਦਾ ਸੀ ਕਦੇ ਕਦਾਰ ਦਾਲ ਜ਼ਿਆਦਾ ਵੱਧ ਜਾਂਦੀ ਸੀ ਕਦੇ ਉਹਦੇ ਵਿੱਚ ਘੀ ਘੱਟ ਰਹਿ ਜਾਂਦਾ ਸੀ ਕਦੇ ਜ਼ਿਆਦਾ ਜਲ ਜਾਂਦਾ ਸੀ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਹੌਲੀ ਹੌਲੀ ਬਣਾਉਣਾ ਸਿੱਖ ਗਿਆ ਅਤੇ ਹੁਣ ਮੈਂ ਇਸ ਤਰੀਕੇ ਦੇ ਉਸ ਅਨੁਭਵ ਦੀ ਗੱਲ ਕਰਾਂ ਅਤੇ ਹੁਣ ਮੈਂ ਇੰਨਾਂ ਵਧੀਆ ਮੂੰਗੀ ਦਾਲ ਦਾ ਹਲਵਾ ਬਣਾ ਲੈਂਦਾ ਹਾਂ ਕਿ ਹਲਵਾਈਆਂ ਦੇ ਤੋਂ ਵੀ ਜ਼ਿਆਦਾ ਵਧੀਆ ਟੇਸਟੀ ਲੱਗਦਾ ਹੈ ਮੈਨੂੰ ਅਤੇ ਹੁਣ ਜਦੋਂ ਵੀ ਮੇਰਾ ਦਿਲ ਕਰਦਾ ਹੈ ਤਾਂ ਮੈਂ ਆਪਣੇ ਆਪ ਆਸਾਨੀ ਨਾਲ ਹੁਣ ਕਿਉਂਕਿ ਮੈਂ ਸਿੱਖ ਗਿਆ ਹਾਂ ਤਾਂ ਚੱਜ ਨਾਲ ਬਣਾ ਲੈਂਦਾ ਹਾਂ ਅਤੇ ਆਰਾਮ ਨਾਲ ਸਾਰੇ ਪਰਿਵਾਰ ਨਾਲ ਖਾਂਦਾ ਹਾਂ